ਅੱਜ ਕੱਲ੍ਹ ਦੇ ਦਿਨਾਂ ਵਿੱਚ ਰੂਪਨਗਰ ਜ਼ਿਲ੍ਹੇ ਦੇ ਵਿੱਚ ਲੋਕਾਂ ਦੁਆਰਾ ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਅਤੇ ਜਿਸ 'ਤੇ ਸਾਡੇ ਰੂਪਨਗਰ ਜਿਗ ਜ਼ਿਲ੍ਹੇ ਦੇ ਨਾਗਰਿਕ ਪਾਲ ਪਾਲਿਕਾ ਦਾ ਦੀ ਵੀ ਕੋਈ ਅੱਖ ਨਹੀਂ ਹੈ ਅਤੇ ਮੈਂ ਇਹ ਅਪੀਲ ਕਰਦੀ ਹਾਂ ਪੁਰ ਜ਼ੋਰ ਅਪੀਲ ਕਰਦੀ ਹਾਂ ਕਿ ਉਹ ਇਸ 'ਤੇ ਧਿਆਨ ਦੇਣ ਜਿਸ ਕਰਕੇ ਜਿਹੜਾ ਸਤਲੁਜ ਦਰਿਆ ਵਾਲਾ ਸਾਰਾ ਹਿੱਸਾ ਹੈ ਉਸ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਅਤੇ ਉਸ 'ਤੇ ਉਸ ਦੇ ਰਾਹ 'ਤੇ ਆਉਣ ਵਾਲੀ ਸਾਰੀ ਹਰਿਆਈ ਨੂੰ ਕੱਟਿਆ ਜਾਵੇ ਜਿਸ ਕਰਕੇ ਛੋਟੇ ਬੱਚੇ ਅਤੇ ਵੱਡੇ ਉੱਥੇ ਜਾ ਕੇ ਆਪਣਾ ਸਮਾਂ ਬਤੀਤ ਕਰ ਸਕਦੇ ਹਨ ਅਤੇ ਆਪਣਾ ਸਮਾਂ ਇੱਕ ਦੂਜੇ ਨਾਲ ਗੁਜ਼ਾਰ ਸਕਦੇ ਹਨ